ਹੈਲੋ ਸਤੀ ਸ਼੍ਰੀ ਅਕਾਲ ਮੈਮ ਸਤੀ ਸ਼੍ਰੀ ਅਕਾਲ ਜੀ ਠੀਕ ਹੈ ਜੀ ਵਧੀਆ ਜੀ ਮੈਂ ਫ੍ਰੀ ਹਾਂ ਜੀ ਹਾਂਜੀ ਤੁਸੀਂ ਦੱਸੋ ਕਿੱਦਾਂ ਜੀ ਮੈਮ ਓਕੇ

ਮੈਮ ਇੱਦਾਂ ਹੋਇਆ ਅਗਰ ਤੁਸੀਂ ਬੱਚਿਆਂ ਦੇ ਨਾਲ ਹੋ ਤਾਂ ਇੱਕ ਚਿੰਤਪੁਰਨੀ ਰੋਡ ਦੇ ਉੱਤੇ ਹੀ ਬੋਂਬੇ ਪਿਕਨਿਕ ਸਪੋਟ ਹੈਗਾ ਇਆ ਉੱਥੇ ਵਧੀਆ ਵੈੱਜ ਖਾਣਾ ਤੇ ਪਲੱਸ ਬੱਚਿਆਂ ਦੇ ਖੇਡਣ ਲਈ ਪਾਰਕ ਝੂਲੇ ਵਗੈਰਾ ਸਾਰਾ ਕੁਛ ਵਧੀਆ ਫਸਿਲਟੀਜ ਨੇ ਉੱਥੇ ਤੁਸੀਂ ਰੁੱਕ ਸਕਦੇ ਓਂ ਨਾਲ ਖਾਣ ਦੀਆ ਆਈਟਮਾਂ ਵੀ ਜੀ ਜੀ ਜੀ ਮੈਮ ਮੈਮ ਉਸ ਤੋਂ ਇਲਾਵਾ ਜਿੱਦਾਂ ਕਿ ਉੱਥੋਂ ਹੀ ਆਉਂਦੇ ਹੋਏ ਅੰਬਰ ਪੈਲਸ ਅੰਬਰ ਰੈਸਟੋਰੇਂਟ ਹੈਗਾ ਆ ਅਤੇ ਉੱਥੇ ਵੀ ਤੁਸੀਂ ਰੁੱਕ ਸਕਦੇ ਓਂ ਜੇ ਉੱਥੇ ਕੋਈ ਚਾਈਨੀਜ਼ ਫ਼ੂਡ ਵਗੈਰਾ ਖਾਣਾ ਚਾਹੁੰਦੇ ਓਂ ਜਾਂ ਕੋਈ ਵਧੀਆ ਖਾਣ ਪੀਣ ਲਈ ਐਟਮਾਂ ਐਕਸਟਰਾ ਲੈਣਾ ਚਾਹੁੰਦੇ ਹੋ ਉੱਥੇ ਵੀ ਹਾਂ ਅਤੇ ਨਹੀਂ ਮੈਮ ਚਿਕਨ ਵਗੈਰਾ ਤਾਂ ਨਹੀਂ ਹੈਗਾ ਗਾ ਤੁਸੀਂ ਇੱਦਾਂ ਵੈੱਜ ਸਾਰਾ ਕੁਛ ਮਿਲੇਗਾ ਤੁਹਾਨੂੰ ਕੋਈ ਵੀ ਇੱਦਾਂ ਨੌਨ ਵੈੱਜ ਦਾ ਨਹੀਂ ਹੈਗਾ ਗਾ ਉੱਥੋਂ ਦੀ ਸਟਾਫ਼ ਵੀ ਬਹੁਤ ਅੱਛਾ ਹੈ ਨਾਲ ਨਾਲ ਤੁਹਾਨੂੰ ਉੱਥੇ ਰੂਮ ਵੀ ਸਟੇਅ ਕਰਨ ਨੂੰ ਮਿਲ਼ ਜਾਣਗੇ ਬੱਚਿਆਂ ਦੇ ਨਾਲ ਤੁਸੀਂ ਕੁਛ ਘੰਟਾ ਦੋ ਘੰਟੇ ਸਪੈਂਡ ਕਰ ਸਕਦੇ ਹੋ ਅਤੇ ਵਿਊ ਵੀ ਅੱਛਾ ਉੱਥੇ ਲੋਕੇਸ਼ਨ ਵੀ ਬਹੁਤ ਵਧੀਆ ਅੰਬਰ ਦੇ ਵਿਚ ਵੀ ਹਾਂ ਮੈਮ ਅੰਬਰ ਵੀ ਵਧੀਆ ਆ ਔਰ ਬੋਂਬੇ ਪਿਕਨਿਕ ਦੇ ਵਿਚ ਤਾਂ ਇੱਦਾਂ ਹੈ ਕਿ ਬੱਚਿਆਂ ਲਈ ਖੇਡਣ ਦੇ ਨਾਲ ਖਾਣ ਪੀਣ ਦੇ ਨਾਲ ਨਾਲ ਖੇਡਾਂ ਦੇ ਵੀ ਵਧੀਆ ਝੂਲੇ ਵਗੈਰਾ ਲੱਗੇ ਹੋਏ ਆ ਬੋਟਿੰਗ ਕਰਨ ਲਈ ਵੀ ਹੈਗਾ ਆ ਉੱਥੇ ਔਰ ਬੱਚਿਆਂ ਨੂੰ ਹਾਊਸ ਰੈਡਿੰਗ ਵੀ ਹੈਗਾ ਉੱਥੇ ਤੁਸੀਂ ਬੱਚਿਆਂ ਨਾਲ ਹਾਂ ਪਾਰਕਿੰਗ ਵਗੈਰਾ ਵਧੀਆ ਇਆ ਔਰ ਫਾਸਿਲਿਟੀਜ਼ ਤੁਹਾਨੂੰ ਖਾ ਪੀਣ ਦੇ ਵਿੱਚ ਹਾਂਜੀ ਮੈਂ ਉੱਥੇ ਗਿਆ ਹੋਇਆਂ ਜੀ ਮੈਂ ਉੱਥੇ ਕਾਫ਼ੀ ਟੈਮ ਪਹਿਲਾਂ ਦੀ ਜਾ ਕੇ ਆਇਆਂ ਹੁਣ ਵੀ ਜਾ ਕੇ ਆਇਆਂ ਜਦੋਂ ਵੀ ਜਾਈਦਾ ਆਪਾਂ ਉੱਥੇ ਜਾਈਦਾ ਆ ਨਾਲ ਖਾਣਾ ਪੀਣਾ ਅਤੇ ਨਾਲੇ ਬੱਚਿਆਂ ਨੂੰ ਉੱਥੇ ਖਲਾਉਣਾ ਬਹੁਤ ਵਧੀਆ ਲੱਗਦਾ ਉੱਥੇ ਤੁਸੀਂ ਜਾਓ ਅਤੇ ਹਾਂਜੀ ਜੀ ਜ਼ਰੂਰ ਆਵਾਂਗਾ ਫਿਲਹਾਲ ਤੁਸੀਂ ਇੱਕ ਵਾਰ ਉੱਥੇ ਜਾ ਕੇ ਆਓ ਅਤੇ ਉੱਥੇ ਐਕਸਪੀਰੀਐਂਸ ਲਓ ਉੱਥੋਂ ਦਾ ਕਿੱਦਾਂ ਇਆ ਖਾਣ ਪੀਣ ਦਾ ਜਿੱਦਾਂ ਕਿ ਖਾਣ ਪੀਣ ਦੇ ਵਿੱਚ ਮੈਮ ਖਾਣ ਪੀਣ ਦੇ ਵਿੱਚ ਜਿੱਦਾਂ ਕਿ ਸਿੰਪਲ ਆਪਾਂ ਗੱਲ ਕਰੀਏ ਤਾਂ ਕੜਾਈ ਪਨੀਰ ਪਨੀਰ ਦੀਆਂ ਸਬਜ਼ੀਆਂ ਵਧੀਆ ਨੇ ਉੱਥੇ ਉੱਥੇ ਖਾ ਸਕਦੇ ਹੋ ਤੁਸੀਂ ਅਤੇ ਅਗਰ ਫ਼ੂਡ ਆਪਾਂ ਚਾਈਨੀਜ਼ ਫ਼ੂਡ ਦੇ ਵਿੱਚ ਹੈਗਾ ਕਰੀਮੀ ਰੋਲਸ ਵਗੈਰਾ ਖਾ ਸਕਦੇ ਹੋ ਅਤੇ ਹੋਰ ਵੀ ਬਹੁਤ ਐਟਮਾਂ ਨੇ ਉੱਥੇ ਤਾਂ ਮੈਨਿਊ ਤੁਸੀਂ ਦੇਖਿਓ ਜੇ ਵਧੀਆ ਨੇ ਉੱਥੋਂ ਦੇ ਸਟਾਫ਼ ਦੀ ਵੀ ਬਹੁਤ ਵਧੀਆ ਬੋਲਬਾਣੀ ਵਧੀਆ ਉਹ ਤੁਹਾਨੂੰ ਵਧੀਆ ਹੈਲਪਫੁਲ ਕਰਨਗੇ ਨਾਲ ਖਾਣ ਪੀਣ ਦੇ ਵਿੱਚ ਵੀ ਜੀ ਹਾਂਜੀ ਮੈਮ ਅਤੇ ਮੈਮ ਹੋਰ ਬੱਚਿਆਂ ਦੇ ਲਈ ਵੀ ਸਾਰਿਆਂ ਨਾਲੋਂ ਤਾਂ ਵਧੀਆ ਉੱਥੇ ਬੱਚੇ ਵੀ ਤਹਾਡੇ ਖੇਡਣਗੇ ਤਾਂ ਉਨ੍ਹਾਂ ਨੂੰ ਵੀ ਵਧੀਆ ਇੰਜੋਆਏ ਵਧੀਆ ਲੱਗੇਗਾ ਉੱਥੋਂ ਦਾ ਟਾਈਮ ਜਿੰਨਾ ਵੀ ਤੁਸੀਂ ਨਾਲ ਉੱਥੇ ਫੋਟੋਗ੍ਰਾਫੀ ਵੀ ਕਰ ਸਕਦੇ ਓਂ ਬੱਚਿਆਂ ਦੇ ਨਾਲ ਕੁਛ ਯਾਦਾਂ ਜਿਹੜੀਆਂ ਕਿ ਨਾਲ ਤੁਸੀਂ ਰੱਖ ਸਕਦੇ ਓਂ ਅਤੇ ਸਾਰਿਆਂ ਨਾਲੋਂ ਵਧੀਆ ਗੱਲ ਇਹ ਆ ਕਿ ਤੁਹਾਨੂੰ ਕੋਈ ਔਖਾ ਨਹੀਂ ਕਿਉਂਕਿ ਤੁਸੀਂ ਉੱਧਰ ਦੀ ਹੀ ਆਉਣਾ ਆ ਤਾਂ ਆਓਂਦੇ ਅੱਛੀ ਗੱਲ ਹੈ ਨਾ ਅਤੇ ਉੱਥੇ ਪਾਰਕਿੰਗ ਲਗਾਓ ਅਤੇ ਨਾਲ ਹੀ ਤੁਸੀਂ ਆਪਣਾ ਇੰਜੋਆਏ ਕਰੋ ਤੁਹਾਨੂੰ ਬੈਟਰ ਲੱਗੇਗਾ ਵਧੀਆ ਫੀਲ ਹੋਏਗਾ ਖਾਣ ਪੀਣ ਦੇ ਵੀ ਓਕੇ ਥੈਂਕ ਉ ਜੀ ਥੈਂਕ ਉ